ਹੁਣ ਇੱਕ ਮਤਲਬ ਜੇ ਬੈਂਕ ਕਰਮਚਾਰੀ ਤਾਂ ਨਹੀਂ ਜਾਂ ਇੱਕ ਬੀਮਾ ਏਜੰਟ ਨੂੰ ਮਤਲਬ ਲੋਕਾਂ ਨੂੰ ਇਹ ਸਮਝਾਉਣਾ ਬੜਾ ਔਖਾ ਲੱਗਦਾ ਕਿ ਬੀਮਾ ਹੈ ਕੀ ਹੈ ਲੋਕ ਇਹੀ ਸਮਝਦੇ ਹੈ ਕਿ ਅਸੀਂ ਮਤਲਬ ਮਰ ਗਏ ਤਾਂ ਸਾਨੂੰ ਪੈਸਾ ਮਿਲ ਜਾਵੇਗਾ ਲੋਕ ਇਹ ਨਹੀਂ ਸੋਚਦੇ ਕਿ ਇਹ ਇੱਕ ਸਾਡੀ ਇੱਕ ਬੱਚਤ ਹੈ ਅਸੀਂ ਬੱਚਤ ਤਾਂ ਕਰਦੇ ਹੀ ਕਰਦੇ ਹਾਂ ਅਤੇ ਕੱਲ੍ਹ ਨੂੰ ਜੇ ਅਸੀਂ ਨਹੀਂ ਵੀ ਰਹਿੰਦੇ ਤਾਂ ਸਾਡਾ ਪਰਿਵਾਰ ਜਿਹੜਾ ਕਿਸੇ ਅੱਗੇ ਹੱਥ ਨਹੀਂ ਉਹਨੂੰ ਅੱਗੇ ਕਰਨਾ ਪੈਂਦਾ ਹੈ ਨਾ ਮਤਲਬ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਕਿ ਅਸੀਂ ਬੀਮਾ ਕਰਵਾਇਆ ਅਤੇ ਸਾਡੇ ਪਰਿਵਾਰ ਨੂੰ ਇੱਕ ਸੋਹਣੀ ਰਕਮ ਮਿਲ ਜਾਂਦੀ ਹੈ ਜਿਹਦੇ ਨਾਲ ਆਪਣਾ ਫਾਨੈਂਸ ਅ ਅੱਛਾ ਕਰ ਸਕਦੇ ਆ ਅਤੇ ਹੋਰ ਵੀ ਮਤਲਬ ਜਿੱਦਾਂ ਸਿਹਤ ਬੀਮਾ ਦੇ ਵਿੱਚ ਤੁਸੀਂ ਕਈ ਤੁਹਾਨੂੰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਤੁਸੀਂ ਆਪਣਾ ਉਹਦਾ ਇਲਾਜ ਕਰਵਾ ਸਕਦੇ ਹੋ ਉਸ ਬੀਮਾ ਦੇ ਵਿੱਚ ਉਹ ਤੁਹਾਨੂੰ ਸਾਰਾ ਰਿਫੰਡ ਹੋ ਜਾਂਦਾ ਪੈਸਾ ਹੈ ਨਾ ਅਤੇ ਉਹਨਾਂ ਚੀਜ਼ਾਂ ਦੇ ਨਾਲ ਜਿਹੜਾ ਬੀਮਾ ਕੰਪਨੀਆਂ ਵਧੀਆ ਅੱਜ ਕੱਲ੍ਹ ਕਰ ਰਹੀਆਂ ਪਰ ਲੋਕਾਂ ਨੂੰ ਥੋੜ੍ਹਾ ਸਮਝਾਉਣ ਵਿੱਚ ਥੋੜ੍ਹੀ ਮੁਸ਼ਕਲ ਆਉਂਦੀ ਹੈ ਲੋਕ ਸਮਝਣਾ ਵੀ ਨਹੀਂ ਚਾਹੁੰਦੇ ਲੋਕਾਂ ਨੂੰ ਲੱਗਦਾ ਕਿ ਬੀਮੇ ਵਾਲੇ ਮਤਲਬ ਜਿੱਦਾਂ ਬੇਫਜ਼ੂਲ ਹੀ ਤੁਰੇ ਫਿਰਦੇ ਆ ਹੈ ਨਾ ਜਦੋਂ ਅਸੀਂ ਸਾਨੂੰ ਵੀ ਮੇਰੀ ਉਦੋਂ ਸਮਝ ਆਉਂਦੀ ਸਾਡੇ ਘਰ ਦਾ ਕੋਈ ਚਲਿਆ ਜਾਂਦਾ ਆ ਤਾਂ ਸਾਨੂੰ ਮਤਲਬ ਕੋਈ ਵੀ ਕੁਛ ਦੇਣ ਨਹੀਂ ਆਉਂਦਾ ਇੱਕ ਬੀਮਾ ਏਜੰਟ ਹੀ ਹੁੰਦਾ ਜਿਹੜਾ ਆ ਕੇ ਸਾਡੇ ਹੱਥ ਵਿੱਚ ਇੱਕ ਸੋਹਣੀ ਰਕਮ ਦੇ ਕੇ ਜਾਂਦਾ ਆ ਅਤੇ ਬਾਕੀ ਸਭ ਤੁਹਾਨੂੰ ਸਮਝਾਉਣਾ ਇਹ ਅੱਛੀ ਗੱਲ ਹੈਗੀ ਹੈ ਸਮਝਾਉਣਾ ਚਾਹੀਦਾ ਲੋਕਾਂ ਨੂੰ ਇਸ ਬਾਰੇ